ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਇਹ ਰੰਧਾਵਾ ਟੂਰ ਐਂਡ ਟਰੈਵਲ ਤੋਂ ਬੋਲਦੇ ਜੀ ਜੀ ਹਾਂਜੀ ਬੇਨਤੀ ਆ ਆਪਣੀ ਜੀ ਅਸੀਂ ਕਪੂਰਥਲੇ ਤੋਂ ਬੋਲਦੇ ਆ ਨਾ ਜੀ ਤੁਸੀਂ ਹਾਂਜੀ ਆਪਾਂ ਤੁਹਾਡਾ ਨੰਬਰ ਮਿਲਿਆ ਸੀਗਾ ਔਨਲਾਈਨ ਆਪਾਂ ਨੈੱਟ ਦੇ ਉੱਤੋਂ ਸਰਚ ਕੀਤਾ ਸੀਗਾ ਅਤੇ ਅਸੀਂ ਜਿੱਦਾਂ ਕ ਕਪੂਰਥਲਾ ਸ਼ਹਿਰ ਆਪਾਂ ਘੁੰਮਣਾ ਹੋਵੇ ਗੁਰਦੁਆਰਾ ਸਾਹਿਬ ਕਪੂਰਥਲੇ ਦੇ ਵਿੱਚ ਜਿਹੜੇ ਇਤਿਹਾਸਿਕ ਵਧੀਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੋਣ ਤੁਸੀਂ ਦੱਸ ਸਕਦੇ ਹੈ ਜੀ ਆਪਣੇ ਵੀ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਆ

ਨਹੀਂ ਅਸੀਂ ਮਤਲਬ ਕਹਿ ਲਓ ਕਿ ਦੋ ਦਿਨ ਬਾਅਦ ਪਰਸੋਂ ਨੂੰ ਆ ਜਾਵਾਂਗੇ ਪਰਸੋਂ ਨੂੰ ਵੀ ਆ ਸਕਦੇ ਹੋ ਹਾਂਜੀ ਫੈਮਲੀ ਆ ਪੂਰੀ ਅਸੀਂ ਮਤਲਬ ਚਾਰ ਮੈਂਬਰ ਆ ਟੋਟਲ ਜੀ ਠੀਕ ਹੈ ਜੀ ਇਹ ਆਪਣੇ ਇਹ ਕਿੰਨਾ ਦੋ ਹਜ਼ਾਰ ਦੱਸਿਆ ਜੀ ਤੁਸੀਂ ਚਾਰ ਜਣਿਆਂ ਦਾ ਠੀਕ ਠੀਕ ਆ ਜੀ ਅਤੇ ਆਪਣੇ ਇੱਥੇ ਲਾਗੇ ਸੁਲਤਾਨਪੁਰ ਸਾਹਿਬ ਵੀ ਗੁਰਦੁਆਰਾ ਸਾਹਿਬ ਹੈਗੇ ਆ ਨਾ ਜੀ ਇਤਿਹਾਸਿਕ ਨਹੀਂ ਇਹ ਟੋਟਲ ਇੱਕ ਇੱਕ ਦਿਨ ਦਾ ਪੈਕਜ ਆ ਇੱਕ ਦਿਨ ਦੇ ਵਿੱਚ ਵੀ ਹੋ ਜਾਂਦਾ ਜੀ ਕਵਰੇਜ ਇੱਕ ਦਿਨ ਜੀ ਹਾਂ

ਠੀਕ ਨਹੀਂ ਨਹੀਂ ਆਪਣੇ ਇਕ ਇੱਕ ਦਿਨ ਦਾ ਹੀ ਰੱਖੀਏ ਹੈ ਨਾ ਜੀ ਇਕ ਇੱਕ ਦਿਨ ਦੇ ਵਿੱਚ ਕੋਈ ਗੱਲ ਮੈਂ ਤੁਹਾਨੂੰ ਫੋਨ 'ਤੇ ਕਲੀਅਰ ਕਰ ਠੀ ਧੰਨ ਧੰਨਵਾਦ ਧੰਨਵਾਦ ਜੀ ਮੈਂ ਤੁਹਾਨੂੰ ਕਲੀਅਰ ਕਰਕੇ ਫੋਨ ਕਰਕੇ ਤੁਹਾਨੂੰ ਦੱਸ ਦਿੰਦਾ ਜੀ ਤੁਹਾਨੂੰ ਬੁੱਕ ਕਰਾ ਲੈਂਦਾ ਜੀ ਠੀਕ ਹੈ ਜੀ